ਪੰਜਾਬ ਵਿੱਚ ਰਾਜਨੀਤਿਕ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨਾਗਰਿਕਾਂ ਨੂੰ ਬੜੇ ਬੜੇ ਵਧੀਆ ਤਰੀਕੇ ਨਾਲ ਭਾਗ ਲੈ ਸਕਦੇ ਨਾਗਰਿਕ ਪੰਜਾਬ ਦੇ ਨਾਗਰਿਕ ਵੀ ਉਹਨਾਂ ਨੂੰ ਅਠਾਰ੍ਹਾਂ ਸਾਲ ਦੀ ਉਮਰ ਵਿਚ ਆਪਣਾ ਉਮੀਦਵਾਰ ਚੁਣਨ ਦੇ ਵੀ ਹੱਕ ਹੋ ਗਿਆ ਹੋਵੇ ਅਤੇ ਬਾਕੀ ਜਿਹੜਾ ਉੱਥੇ ਥਾਂ ਥਾਂ 'ਤੇ ਸਾਡੇ ਸ਼ਿਕਾਇਤ ਦਰਜ ਕਰਨ ਵਾਸਤੇ ਕਈ ਚੀਜ਼ ਬਣਾ ਆਫਿਸ ਬਣਾ ਦਿੱਤੇ ਗਏ ਨੇ ਅਤੇ ਉੱਥੇ ਬੰਦਾ ਆਪਣੀ ਸ਼ਿਕਾਇਤ ਵੀ ਕ ਜੇ ਕੋਈ ਸਾਨੂੰ ਨਹੀਂ ਕੁਝ ਵੀ ਪਸੰਦ ਅਤੇ ਉਹ ਆਪਣੀ ਸ਼ਿਕਾਇਤ ਉੱਥੇ ਲਿਖ ਸਕ ਲਿਖਵਾ ਸਕਦਾ ਵੇ ਅਤੇ ਗੌਰਮੈਂਟ ਵੀ ਧਿਆਨ ਦਿੰਦੀ ਹੈ ਸਰਕਾਰ ਧਿਆਨ ਦਿੰਦੀ ਹੈ ਉਹ ਸ਼ਿਕਾਇਤ ਬਈ ਲੋਕੀ ਕੀ ਪਸੰਦ ਕਰਦੇ ਨੇ ਕੀ ਨਹੀਂ ਉਹ ਫਿਰ ਉਸ ਚੀਜ਼ 'ਤੇ ਅਮਲ ਕਰਦੀ ਹੈ ਅਤੇ ਉਹ ਜੋ ਜਨਤਾ ਦੇ ਹੱਕ ਵਿੱਚ ਹੁੰਦਾ ਉਹ ਉਹਨੂੰ ਅਮਲ ਵੀ ਕਰਦੀ ਹੈ ਅਤੇ ਉਹ ਵਾਲੇ ਉੱਥੇ ਰੂਲ ਕਰਦੀ ਹੈ ਬਾਕੀ ਜਿਵੇਂ ਹੈ ਸਾਰਾ ਚੋਣਾਂ ਦਾ ਹਿਸਾਬ ਕਿਤਾਬ ਹੈ ਚੋਣਾਂ ਵੀ ਬੜੀਆਂ ਵਧੀਆ ਹੁੰਦੀਆਂ ਨੇ ਬੱਚੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਕਿ ਅਸੀਂ ਵੀ ਆਪਣੀ ਸਰਕਾਰ ਨੂੰ ਕਹਿ ਸਕਦੇ ਹਾਂ ਆਪਣੇ ਆਪਣੇ ਦਿਲ ਦੀ ਗੱਲ ਜੋ ਠੀਕ ਗੱਲਾਂ ਨੇ ਧੰਨਵਾਦ ਜੀ